ਜੇਕਰ ਖੇਡਾਂ ਖੇਡਦੇ ਸਮੇਂ ਸਾਨੂੰ ਸੱਟ ਲੱਗ ਜਾਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਆਪਣਾ ਹੀ ਨੁਖਸਾ ਬਦ ਆਪਣਾ ਹੀ ਇਲਾਜ ਕਰਦੇ ਹਾਂ ਇ ਦੇਸੀ ਨੁਸਕੇ ਜਿਵੇਂ ਕਿ ਕੋਈ ਪੱਟੀ ਬੰਨ ਦੇਣੀ ਜਾਂ ਉਸਦਾ ਸਾਹ ਦੀ ਦਿੱਕਤ ਹੈ ਤਾਂ ਸਾਹ ਦਵਾਉਣ ਦੀ ਕੋਸ਼ਿਸ਼ ਕਰਨੀ ਉਸ ਨੂੰ ਜੇ ਉਸ ਨੂੰ ਬੁਖਾਰ ਹੋ ਗਿਆ ਹੈ ਤਾਂ ਠੰਡੇ ਪਾਣੀ ਦੀਆਂ ਪੱਟੀਆਂ ਕਰ ਦੇਣੀਆਂ ਜਿਸ 'ਤੇ ਸੱਟ ਲੱਗੀ ਆ ਤਾਂ ਉਸਨੂੰ ਚੱਕ ਕੇ ਫਟਾਫਟ ਆ ਕਮਰੇ 'ਚ ਲੈ ਜਾਓ ਤਾਂ ਉੱਥੇ ਕਮਰਾ ਨਹੀਂ ਹੈ ਤਾਂ ਆਪਾਂ ਇਸ ਤਰ੍ਹਾਂ ਹੀ ਲਟਾ ਕੇ ਉਸਨੂੰ ਪੱਟੀ ਆਦਿ ਨਾਲ ਸਾਫ਼ ਕਰ ਸਕਦੇ ਹਾਂ ਜਖ਼ਮ ਨੂੰ ਅਤੇ ਫਿਰ ਛੇਤੀ ਨਾਲ ਨਾਲ ਦੇ ਹੋਸਪਿਟਲ 'ਚ ਆਪਾਂ ਲੈ ਕੇ ਜਾ ਸਕਦੇ ਹਾਂ ਅਤੇ ਐਂਬੂਲੈਂਸ ਨੂੰ ਪਹਿਲਾਂ ਫ਼ੋਨ ਕਰੋ ਐਬੂਲੈਂਸ ਨੂੰ ਫ਼ੋਨ ਕਰਕੇ ਨਾਲ ਦੇ ਹੋਸਪੀਟਲ 'ਚ ਆਪਾਂ ਉਸ ਪੇਸ਼ੈਂਟ ਨੂੰ ਲੈ ਕੇ ਜਾ ਸਕਦੇ ਹਾਂ